ਜੇਕਰ ਗੱਲ ਕੀਤੀ ਜਾਵੇ ਸਾਈਕਲ ਦੀ ਸਾਈਕਲ ਤਾਂ ਮੈਂ ਬਹੁਤ ਹੀ ਚਲਾਈ ਹੈ ਪਰ ਛੋਟੇ ਹੁੰਦਿਆਂ ਹੀ ਚਲਾਈ ਹੋਈ ਹੈ ਜੇਕਰ ਗੱਲ ਕੀਤੀ ਜਾਵੇ ਵੱਡੇ ਹੋ ਕੇ ਸਾਈਕਲ ਤੇ ਚਹੋਈ ਚੁਣੌਤੀਪੂਰਨ ਤਾਂ ਉਸ 'ਤੇ ਰਿਕਾਰਡਿੰਗ ਵੀ ਤਾਂ ਕੋਈ ਨਹੀਂ ਹੈ ਅਗਰ ਗੱਲ ਕਰੋ ਬਾਈਸਾਈਕਲ ਦੀ ਬਾਈਸਾਈਕਲ ਤਾਂ ਬਹੁਤ ਹੀ ਜ਼ਿਆਦਾ ਚੁਣੌਤੀਪੂਰਨ ਸੜਕਾਂ ਨਾਪੀਆਂ ਹੋਈਆਂ ਹਨ ਅਗਰ ਮੇਨਲੀ ਗੱਲ ਕੀਤੀ ਜਾਏ ਮੇਰੇ ਘਰ ਦੇ ਬਾਹਰ ਬਟਾਲਾ ਰੋਡ ਦੀ ਹੀ ਉਹ ਪੂਰੀ ਪੂਰੀ ਪੁੱਟੀ ਹੋਈ ਹੈ ਜੋ ਕਿ ਪੂਰੀ ਉਬੜ ਖਾਬੜ ਹੈ ਜਿਸ ਨੂੰ ਅਸੀਂ ਔਫ ਰੋਡਿੰਗ ਦਾ ਨਾਮ ਵੀ ਦੇ ਸਕਦੇ ਹਾਂ ਬਾਈਸਾਈਕਲ 'ਤੇ ਮੇਰੇ ਕੋਲ ਬੁਲਟ ਹੈ ਬੁਲਟ ਦੇ ਉੱਤੇ ਮੈਂ ਉਹ ਵਾਲੀ ਸੜਕ ਨੂੰ ਬਹੁਤ ਹੀ ਤੇਜ ਵੀ ਪਾਰ ਕਰ ਚੁੱਕਾ ਹਾਂ ਅਤੇ ਛੋਟੀ ਜਿਹੀ ਸੜਕ ਨੂੰ ਬੜੀ ਤੇਜੀ ਨਾਲ ਸੱਠ ਸੱਤਰ ਸੌ ਦੀ ਸਪੀਡ 'ਤੇ ਵੀ ਪਾਰ ਕਰ ਚੁੱਕਾ ਹਾਂ ਅਗਰ ਗੱਲ ਕਰੀਏ ਹੋਰ ਕੋਈ ਚ ਚੁਣੌਤੀਪੂਰਨ ਟਰੈਕ ਦੀ ਤਾਂ ਹਾਂ ਲੇਹ ਲੱਦਾਖ ਸਭ ਤੋਂ ਜ਼ਿਆਦਾ ਚੁਣੌਤੀਪੂਰਨ ਟਰੈਕ ਹੈਗਾ ਅਤੇ ਚਿੰਤਪੁਰਨੀ ਦਾ ਟਰੈਕ ਵੀ ਬਹੁਤ ਜ਼ਿਆਦਾ ਚੁਣੌਤੀਪੂਰਨ ਲੱਗਾ ਹੈ ਜੋ ਕਿ ਮੈਂ ਆਪਣੇ ਬੁਲਟ ਦੇ ਉੱਤੇ ਹੀ ਕਵਰ ਕਰ ਚੁੱਕਿਆ ਹਾਂ ਪਿਛਲੇ ਜਨ ਪਿਛਲੇ ਜੂਨ ਦੀਆਂ ਗਰਮੀਆਂ ਵਿੱਚ ਮੈਂ ਅਸੀਂ ਮੈਂ ਅਤੇ ਮੇਰੇ ਯਾਰਾਂ ਦੋਸਤਾਂ ਨੇ ਬੁਲਟ ਬੁਲਟ ਰਾਈਡਿੰਗ ਦਾ ਸੋਚਿਆ ਸੀਗਾ ਜੋ ਕਿ ਸਿੱਧਾ ਹੀ ਮਨਾਲੀ ਵੱਲੋਂ ਹੁੰਦੇ ਹੋਏ ਲੇਹ ਵੱਲ ਜਾਂਦਾ ਹੈ ਅਤੇ ਉਹ ਟਰੈਕ ਬਹੁਤ ਹੀ ਮੁਸ਼ਕਿਲ ਸੀਗਾ ਜਿਹਦੇ ਵਿੱਚ ਛੋਟੀਆਂ ਛੋਟੀਆਂ ਸੜਕਾਂ ਅਤੇ ਸਾਈਡ 'ਤੇ ਦੇਖਣ 'ਤੇ ਨੂੰ ਬਹੁਤ ਹੀ ਜ਼ਿਆਦਾ ਡੂੰਘੀਆਂ ਪਹਾੜੀਆਂ ਸਨ ਜਿੰਨ੍ਹਾਂ ਦੇ ਡਿੱਗਣ 'ਤੇ ਬੰਦਾ ਬਚ ਵੀ ਨਹੀਂ ਸਕਦਾ ਅਸੀਂ ਉਹਨਾਂ ਸੜਕਾਂ 'ਤੇ ਵੀ ਨਿਕਲੇ ਹਾਂ ਅਤੇ ਸੌ ਦੀ ਸਪੀਡ 'ਤੇ ਵੀ ਚਲਾ ਚੁੱਕੇ ਹਾਂ ਇੱਕ ਬੁਲਟ 'ਤੇ ਇੱਕ ਹੀ ਬੰਦਾ ਸਵਾਰ ਹੁੰਦਾ ਹੈ ਅਤੇ ਦਸ ਦਸ ਬੁੱਲਟ ਇਕੱਠੇ ਇੱਕ ਝੁੰਡ ਬਣਾ ਕੇ ਜਾਂਦੇ ਹਨ ਅਗਰ ਗੱਲ ਕੀਤੀ ਜਾਏ ਚਿੰਤਪੂਰਨੀ ਟਰੈਕ ਦੀ ਉੱਥੇ ਘੁੰਮਣ ਘਮੇਰੀਆਂ ਬਹੁਤ ਜ਼ਿਆਦਾ ਹਨ ਜੋ ਕਿ ਪਹਾੜੀ ਰਸਤੇ ਨੂੰ ਕੱਟ ਕੇ ਬਣਾਇਆ ਗਿਆ ਹੈ